ਹੈਲੋ ਹੈਲੋ ਹਾਂਜੀ ਸੰਦੀਪ ਜੀ ਕੀ ਹਾਲ ਚਾਲ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ

ਘਰ ਪਰਿਵਾਰ ਸਭ ਠੀਕ ਠਾਕ ਵਧੀਆ ਤੁਸੀਂ ਦੱਸੋ ਕਿੱਦਾਂ ਘਰ ਸਭ ਹਾਂਜੀ ਕੀ ਕਰੀ ਜਾਂਦੇ ਸੀ ਫਰੀ ਸੀ ਅੱਛਾ ਜੀ ਠੀਕ ਆ ਮੈਨੂੰ ਕੰਮ ਸੀਗਾ ਇੱਕ ਤੁਹਾਡੇ ਨਾਲ ਅਤੇ ਮੈਂ ਤੁਹਾਨੂੰ ਪੁੱਛਣਾ ਸੀ ਮੈਂ ਜਿੱਦਾਂ ਗੜਸ਼ੰਕਰ ਆ ਇੱਥੇ ਮੈਨੂੰ ਕੋਈ ਬੈਸਟ ਕੋਲਿਜ ਨਹੀਂ ਮਿਲ ਰਿਹਾ ਅਤੇ ਮੈਂ ਸਟੱਡੀ ਦੇ ਲਈ ਹੁਸ਼ਿਆਰਪੁਰ ਇੱਥੇ ਕੋਈ ਕੋਲਿਜ ਲੱਭ ਰਹੀ ਹਾਂ ਤੁਸੀਂ ਦੱਸੋ ਮੈਨੂੰ ਕੋਈ ਬੈਸਟ ਕੋਲਿਜ ਇੱਥੇ ਮੈਂ ਪੋਸਟ ਗ੍ਰੈਜੂਏਸ਼ਨ ਲਈ ਆਉਣਾ ਆ ਕੋਲਿਜ ਦੇ ਵਿੱਚ ਹਾਂਜੀ ਹਾਂ ਮੈਂ ਐਮਐਸਸੀ ਮੈਥਸ ਕਰਨੀ ਆ ਹਾਂਜੀ ਹਾਂਜੀ

ਅੱਛਾ ਅੱਛਾ ਅੱਛਾ ਹਾਂਜੀ ਹਾਂਜੀ ਹਾਂਜੀ ਮੈਂ ਬਿਲਕੁਲ ਬਿਲਕੁਲ ਹਾਂਜੀ ਟੀਚਰ ਵਧੀਆ ਪੜ੍ਹਾ ਰਹੇ ਨੇ ਜਿੱਦਾਂ ਟੀਚਰਸ ਦਾ ਕਿੱਦਾਂ ਕਿਦੇ ਬਿਹੇਵੀਅਰ ਵਗੈਰਾ ਅੱਛਾ ਹੈ ਜਿੱਦਾਂ ਕਈ ਵਾਰ ਬੱਚਿਆਂ ਨੂੰ ਬਿਹੇਵੀਅਰ ਨਹੀਂ ਪਸੰਦ ਆਉਂਦਾ ਨਾ ਇੱਦਾਂ ਕਈ ਵਾਰ ਇੱਦਾਂ ਹੁੰਦਾ ਵੀ ਲੈਕਚਰ ਨਹੀਂ ਲੱਗਦੇ ਹੁੰਦੇ ਉਦਾਂ ਹੀ ਘੁੰਮਦੇ ਰਹਿੰਦੇ ਬੱਚੇ ਮੈਡਮ ਲੈ ਨਹੀਂ ਰਹੇ ਲੈਕਚਰ ਨਹੀਂ ਲੈ ਰਹੇ ਮੈਨੂੰ ਇੱਦਾਂ ਨਹੀਂ ਕੁਝ ਚਾਹੀਦਾ ਨਾ

ਹਾਂਜੀ ਹਾਂਜੀ ਠੀਕ ਜਿੱਦਾਂ ਕਿੰਨੇ ਕੁ ਵਜੇ ਫਰੀ ਕਰ ਦਿੰਦੇ ਆ ਕੋਲਿਜ ਤੋਂ ਕਿੰਨੇ ਟਾਈਮ 'ਤੇ ਕਲਾਸਿਸ ਕਿੰਨੇ ਟਾਈਮ ਤੱਕ ਅੱਛਾ ਜੀ ਹਾਂਜੀ ਹਾਂਜੀ ਤਾਂ ਹੀ ਮੈਂ ਤੁਹਾਨੂੰ ਕਾਲ ਕੀਤੀ ਸੀ ਮੈਨੂੰ ਤੁਸੀਂ ਨਜ਼ਰ 'ਚ ਆਏ ਸੀ ਕਿ ਮੈਂ ਤੁਸੀਂ ਹੈਲਪ ਕਰੋਂਗੇ ਕੋਈ ਮੇਰੀ ਮੈਂ ਅਤੇ ਕਿੰਨੀ ਕੁ ਜਿੱਦਾਂ ਕਿ ਐਡਮਿਸ਼ਨ ਫੀ ਕਿੰਨੀ ਕੁ ਲੱਗੇਗੀ ਓਕੇ ਓਕੇ ਓਕੇ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਨਹੀਂ ਹੁਣ ਤਾਂ ਜਿੱਦਾਂ ਸੀਗਾ ਨਾ ਕਿ ਸਾਲ ਦੀ ਹੋ ਗਈ ਆ ਪੋਸਟ ਗ੍ਰੈਜੂਏਸ਼ਨ ਉਹ

ਓਕੇ ਓਕੇ ਠੀਕ ਹੈ ਠੀਕ ਹੈ ਜੀ ਓਕੇ ਓਕੇ ਠੀਕ ਹੈ ਸੰਦੀਪ ਓਕੇ ਹਾਂਜੀ ਹਾਂਜੀ ਜ਼ਰੂਰ ਮੈਨੂੰ ਦੱਸਿਓ ਹੈ ਨਾ ਮੈਂ ਫਿਰ ਮੈਨੂੰ ਪਤਾ ਕਰਕੇ ਦੱਸਿਓ ਇੱਕ ਵਾਰੀ ਫਿਰ ਵੀ ਤੁਸੀਂ ਪਤਾ ਕਰ ਲਿਓ ਹੈ ਨਾ ਜਿੱਦਾਂ ਵੀ ਆ ਫੀਸ ਵਗੈਰਾ ਦਾ ਫਿਰ ਮੈਨੂੰ ਦੱਸਿਓ ਹਾਂਜੀ ਮੈਂ ਕਾਲ ਕਰਾਂਗੀ ਓਕੇ ਓਕੇ ਠੀਕ ਹੈ ਠੀਕ ਹੈ ਬਾਏ ਥੈਂਕ ਯੂ